ਮੈਂ ਬਹੁਤ ਸਾਰੀਆਂ ਭਾਸ਼ਾਵਾਂ ਦਾ ਅਨੁਵਾਦ ਕੀਤਾ ਹੈ ਜਿਵੇਂ ਪੰਜਾਬੀ ਤੋਂ ਅੰਗਰੇਜ਼ੀ ਹਿੰਦੀ ਤੋਂ ਪੰਜਾਬੀ ਅਤੇ ਇੱਕ ਵਾਰ ਜਦੋਂ ਮੈਂ ਸਕੂਲ ਵਿੱਚ ਪੜ੍ਹਦੀ ਸੀ ਗਿਆਰਵੀਂ ਕਲਾਸ ਵਿੱਚ ਪੜ੍ਹਦੀ ਸੀ ਉਦੋਂ ਕਲਾਸ ਵਿੱਚ ਟੀਚਰ ਆਈ ਜਿਸ ਕੋਲ ਕਿ ਇੱਕ ਪੇਜ਼ ਸੀ ਜਿਸ ਉੱਤੇ ਪੰਜਾਬੀ ਲਿਖੀ ਹੋਈ ਸੀ ਅਤੇ ਉਹਦਾ ਅੰਗਰੇਜ਼ੀ ਵਿੱਚ ਅਨੁਵਾਦ ਕਰਨਾ ਸੀ ਅਤੇ ਉਹਨਾਂ ਨੇ ਇਕੱਲੇ ਇਕੱਲੇ ਬੱਚੇ ਨੂੰ ਖੜ੍ਹਾ ਕੀਤਾ ਅਤੇ ਕਿਸੇ ਤੋਂ ਵੀ ਪੰਜਾਬੀ ਦਾ ਅੰਗਰੇਜ਼ੀ ਵਿੱਚ ਸਹੀ ਅਨੁਵਾਦ ਨਾ ਕੀਤਾ ਗਿਆ ਅਤੇ ਜਿਹੜੇ ਬੱਚੇ ਆਪਣੇ ਆਪ ਨੂੰ ਬਹੁਤ ਹੁਸ਼ਿਆਰ ਸਮਝਦੇ ਸਨ ਉਹਨਾਂ ਵਿੱਚੋਂ ਵੀ ਕਿਸੇ ਨੇ ਉਸਦਾ ਸਹੀ ਅਨੁਵਾਦ ਨਾ ਕੀਤਾ ਅਤੇ ਜੋ ਕਲਾਸ ਦੀ ਟੋਪਰ ਸੀ ਉਸ ਤੋਂ ਵੀ ਉਸਦਾ ਸਹੀ ਸਹੀ ਅਨੁਵਾਦ ਨਾ ਕੀਤਾ ਗਿਆ ਅਤੇ ਫਿਰ ਜਦੋਂ ਮੇਰੀ ਵਾਰੀ ਆਈ ਤਾਂ ਮੈਂ ਬੜੀ ਨਰਵਸ ਸੀ ਮੈਨੂੰ ਵਿਸ਼ਵਾਸ ਨਹੀਂ ਸੀ ਕਿ ਮੈਂ ਵੀ ਇਸਦਾ ਸਹੀ ਅਨੁਵਾਦ ਕਰ ਸਕਾਂਗੀ ਪਰ ਮੈਂ ਉਸਦਾ ਬਿਲਕੁਲ ਸਹੀ ਅਨੁਵਾਦ ਕੀਤਾ ਅਤੇ ਮੈਨੂੰ ਬੜੀ ਹੈਰਾਨੀ ਹੋਈ ਅਤੇ ਮੈਂ ਉਸਦਾ ਸਹੀ ਅਨੁਵਾਦ ਕੀਤਾ ਸੀ